ਸਾਡੇ ਦੇਸ਼ ਵਿੱਚ ਵੱਖ ਵੱਖ ਰਾਜ ਹਨ ਅਤੇ ਉਨ੍ਹਾਂ ਦੇ ਨਾਚ ਵੀ ਵੱਖ ਵੱਖ ਹੀ ਹਨ ਇਸੇ ਤਰ੍ਹਾਂ ਸਾਡੇ ਪੰਜਾਬ ਵਿੱਚ ਭੰਗੜਾ ਅਤੇ ਗਿੱਧਾ ਦੋ ਫਾਮ ਚੱਲਦੀਆਂ ਹਨ ਭੰਗੜਾ ਇੱਕ ਲੋਕ ਪ੍ਰਸਿੱਧ ਨਾਚ ਹੈ ਜਿਸ ਵਿੱਚ ਬਹੁਤ ਜ਼ਿਆਦਾ ਜੋਸ਼ ਭਰੇ ਸਟੈਪ ਹੁੰਦੇ ਹਨ ਅਸਲ ਵਿੱਚ ਇਹ ਨਾਚ ਕਿਸਾਨਾਂ ਨੇ ਆਪਣੀ ਹੋਈ ਫ਼ਸਲ ਦੀ ਖੁਸ਼ੀ ਮਨਾਉਣ ਲਈ ਸ਼ੁਰੂ ਕੀਤਾ ਸੀ ਭੰਗੜਾ ਇੱਕ ਚੱਕਰ ਵਿੱਚ ਕੀਤਾ ਜਾਂਦਾ ਹੈ ਭੰਗੜੇ ਵਿੱਚ ਲਗਾਤਾਰ ਲੈਅ ਬੱਧ ਬੋਲ ਹੁੰਦੇ ਹਨ ਹੁਣ ਇਹ ਹੌਲੀ ਹੌਲੀ ਇੱਕ ਕਸਰਤ ਦਾ ਰੂਪ ਲੈ ਰਿਹਾ ਹੈ ਕਿਉਂਕਿ ਇਸ ਨਾਚ ਨੂੰ ਜੇਕਰ ਲਗਾਤਾਰ ਸੱਠ ਮਿਨਟ ਤੱਕ ਕੀਤਾ ਜਾਏ ਤਾਂ ਛੇ ਸੌ ਕੈਲਰੀ ਤੱਕ ਦੀ ਖਪਤ ਹੁੰਦੀ ਹੈ ਐਸ ਕਰਕੇ ਐਸ ਨੂੰ ਹੁਣ ਐਰੋਬਿਕਸ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਵੱਖ ਵੱਖ ਪੱਧਰ 'ਤੇ ਵੱਖੋ ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਕਿਉਂਕਿ ਇਸ ਨੂੰ ਹੌਲੀ ਹੌਲੀ ਕਸਰਤ ਦਾ ਰੂਪ ਲੈ ਲਿਆ ਗਿਆ ਹੈ ਅਤੇ ਮੁਕਾਬਲਿਆਂ ਦਾ ਰੂਪ ਵੀ ਲੈ ਲਿਆ ਹੈ ਤਾਂ ਰੂਟੀਨ ਦਾ ਭੰਗੜਾ ਅਤੇ ਮੁਕਾਬਲੇ ਵਾਲਾ ਐਰੋਬਿਕਸ ਦਾ ਭੰਗੜਾ ਇੱਕ ਹੀ ਹਨ ਥੋੜ੍ਹਾ ਜਿਹਾ ਫਰਕ ਹੈ ਕਿ ਉਨ੍ਹਾਂ ਵਿੱਚ ਸਾਜਾਂ ਦੀ ਵਰਤੋਂ ਵੱਖ ਵੱਖ ਹੁੰਦੀ ਹੈ ਕੁਝ ਮੁਕਾਬਲੇ ਨਿੱਜੀ ਤੌਰ 'ਤੇ ਕਰਵਾਏ ਜਾਂਦੇ ਹਨ ਅਤੇ ਕੁਝ ਕਿੱਤੇ ਦੇ ਤੌਰ 'ਤੇ ਕਰਵਾਏ ਜਾਂਦੇ ਹਨ ਇਸ ਤਰ੍ਹਾਂ ਅਸੀਂ ਭੰਗੜਾ ਐਰੋਬਿਕਸ ਦੇ ਐਰੋਬਿਕ ਰੂਟੀਨ ਵਿੱਚ ਰਿਵਾਇਤੀ ਭੰਗੜਾ ਡਾਂਸ ਦੇ ਤੱਤਾਂ ਨੂੰ ਸ਼ਾਮਿਲ ਕਰ ਸਕਦੇ ਹਾਂ